ਹੈਲੋ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਵੀਰੇ ਕੀ ਹਾਲ ਆ ਵਾ ਵਧੀਆ ਵੀਰੇ ਮੈਂ ਨਾ ਪਟਿਆਲੇ ਐਡਮਿਸ਼ਨ ਲਿੱਤੀ ਆ ਪੰਜਾਬੀ ਯੂਨੀਵਰਿਸਟੀ ਪਟਿਆਲਾ ਵਿੱਚ ਮੈਂ ਨਾ ਉਹਦਾ ਸਾਰਾ ਰੂਟ ਰੂਟ ਅਤੇ ਮੈਨੂੰ ਇੱਕ ਪੀ ਜੀ ਵੀ ਲੈਣਾ ਉਹ ਵੀ ਦੱਸ ਦਿਓ ਕਿੰਨੇ ਕੁ ਦੀ ਰੇਂਜ ਦਾ ਦਿੰਦੇ ਨੇ ਪਹਿਲਾਂ ਰੂਟ ਵੀ ਦੱਸ ਦਿਓ ਅਤੇ ਪੀ ਜੀ ਵੀ ਦੱਸ ਦਿਓ ਅੱਛਾ ਕਿੱਥੇ ਕੁ ਪਊਗਾ ਇਹ ਜੀ ਠੀਕ ਹੈ ਠੀਕ ਹੈ

ਅੱਛਾ ਕਿਉਂ ਕੁੜੀਆਂ ਕਿਉਂਕਿ ਅਲਾਊਡ ਨਹੀਂ ਆ ਰੀਜ਼ਨ ਅੱਛਾ ਓਕੇ ਉਹ ਕਿੰਨੀ ਕੁ ਦੀ ਮਿਲਦੀ ਆ ਅੱਛਾ ਫਿਰ ਤਾਂ ਉਹ ਆਊਟ ਔਫ ਬਜਟ ਹੋਜੂਗਾ ਜੀ ਮੈਂ ਇਕੱਲੇ ਨੇ ਹੀ ਰਹਿਣਾ ਜਿਵੇਂ ਕਿ ਮੇਰੀ ਕਿਹੇ ਕਿਸੀ ਫ੍ਰੈਂਡ ਨੇ ਆਉਣਾ ਵਗੈਰਾ ਨੇ ਆਉਣਾ ਹੋਵੇ ਉਹ ਆ ਆ ਸਕਦੀਆਂ ਨੇ ਅੱਛਾ ਉਹ ਕਿੰਨੇ ਕੁ ਦਾ ਮਿਲ ਮਿਲ ਜੂਗਾ ਆਪਾਂ ਨੂੰ ਅੱਛਾ ਜੀ ਚਲੋ ਠੀਕ ਹੈ ਜੀ ਕਮਰਾ ਆਪਾਂ ਨੂੰ ਪਰ ਰਹੂਗਾ ਹੋਰ ਦੱਸੋ ਠੀਕ ਹੈ ਉਹਦੇ ਵਿੱਚ ਬਿਜਲੀ ਦਾ ਖਰਚਾ ਪਾਣੀ ਅੱਡ ਲੱਗਦਾ ਪਾਣੀ ਦਾ ਬਿੱਲ ਵਗੈਰਾ ਅਲੱਗ ਠੀਕ ਹੈ ਜੀ ਅੱਛਾ ਉਹ ਤਾਂ ਕੋਈ ਗੱਲ ਨਹੀਂ ਜੀ ਏ ਸੀ ਊ ਸੀ ਦਾ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਜੀ ਕਿੰਨੇ ਕੁ ਦਾ ਲਾ ਸਕਦੇ ਕਿੰਨੇ ਬਿਲ ਹੋਊਗਾ ਅੱਛਾ ਹੁਣ ਤਾਂ ਜਿਵੇਂ ਸਰਕਾਰ ਨੇ ਬਿਜਲੀ ਫ੍ਰੀ ਕਰੀ ਇੰਨੀ ਤਾਂ ਖਪਦੀ ਵੀ ਨਹੀਂ ਹੈ ਇਸਤੇਮਾਲ ਕਰਨਾ ਤਾਂ ਦੇਣਾ ਹੀ ਪੈਣਾ ਹੈ ਜੀ ਉਹ ਤਾਂ ਸਮਝ ਗਏ ਹਾਂ ਉਹ ਤਾਂ ਕੋਈ ਗੱਲ ਨਹੀਂ ਜੀ ਇੰਨਾ ਤਾਂ ਭਰ ਦੇਵਾਂਗੇ ਅਤੇ ਐਗਰੀਮੈਂਟ ਉਗਰੀਮੈਂਟ ਵੀ ਸਾਈਨ ਹੁੰਦਾ ਕੋਈ ਜਾਂ ਐਗਰੀਮੈਂ ਠੀਕ ਆ ਬਸ ਆਪਾਂ ਨੇ ਬਸ ਰੈਂਟ ਦੇਣਾ ਮੰਥਲੀ ਹੈ ਨਾ ਠੀਕ ਹੈ ਜੀ ਅਤੇ ਵਾ ਮੈਨੂੰ ਮਾੜਾ ਜਿਹਾ ਰੂਟ ਦੱਸ ਦਿਓ ਰੂਟ ਦੱਸ ਦਿਓ ਕਿੱਥੋਂ ਕਿਵੇਂ ਕੀ ਆ ਇਹ ਹਾਂਜੀ

ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਚਲੋ ਠੀਕ ਹੈ ਜੀ ਮੈਂ ਚਲੋ ਫਿਰ ਕਰਦਾ ਜੀ ਮੈਂ ਨਾ ਤੁਹਾਨੂੰ ਕਰਦਾ ਕਾਲ ਬੈਕ ਮੈਨੂੰ ਮੜਾ ਕੰਮ ਹੈ ਜੀ ਓਕੇ